ਹਾਂ ਡਿਜੀਟਲ ਅੱਜਕੱਲ ਬਹੁਤ ਸਾਰੇ ਆ ਗਏ ਫੋਨ ਚ ਵੀ ਬਹੁਤ ਸਾਰੇ ਆ ਗਏ ਕੰਪਿਊਟਰ ਚ ਵੀ ਬਹੁਤ ਸਾਰਾ ਆ ਗਏ ਫੋਨ ਚ ਸਕੈਚ ਨਪਟੋਪ ਕੰਪਿਊਟਰ ਲੈਪਟੋਪ ਕੰਪਿਊਟਰ ਚਪੇਟ ਥਰੀ ਡੀ ਵਗੈਰਾ ਹਨਾ ਆਪਾਂ ਕਿੰਨੇ ਟੂਲਸ ਵਗੈਰਾ ਯੂਜ ਕਰ ਸਕਦੇ ਆਂ ਆਪਾਂ ਸਰਕਲ ਹੋਵੇ ਬਣਿਆ ਤਨਿਆ ਬਣਾ ਸਕਦੇ ਆ ਟਰਗਲ ਸਕਰ ਜਿਵੇਂ ਆਪਣਾ ਜੀ ਕਰਦਾ ਪਿਰਾਮਿਡ ਵਗੈਰਾ ਸਾਰਾ ਕੁਛ ਉਥੇ ਬਣਿਆ ਹੁੰਦਾ ਭਾਵੇਂ ਬਣਾ ਸਕਦੇ ਰੰਗ ਜਿਹੜਾ ਹੈਗਾ ਉਹ ਆਪਾਂ ਉਹ ਆਪਾਂ ਜਿਵੇਂ ਫਿਲਟੋਲ ਹੁੰਦਾ ਉਹਦੇ ਨਾਲ ਆਪਾਂ ਰੰਗ ਕਰ ਸਕਦੇ ਆ ਅਲੱਗ ਅਲੱਗ ਸ਼ੇਪਸ ਸ਼ੇਪਸ ਆਪਾਂ ਬੈਕਗਰਾਊਂਡ ਕਲਰ ਪਹਿਲਾਂ ਕਰ ਸਕਦੇ ਆ ਆਪਾਂ ਅਲੱਗ ਅਲੱਗ ਸਲਾਈਡ ਫਰੇਮਸ ਵੀ ਬਣਾ ਸਕਦੇ ਹੈਗੇ ਆ ਜਿਵੇਂ ਪਹਿਲੀ ਸਲਾਈਡ ਹੁੰਦੀ ਉਹਨੂੰ ਰੰਗ ਕਰਕੇ ਦੂਜੀ ਸਾਈਡ ਹੁੰਦੀ ਉਹਨੂੰ ਰੰਗ ਕਰਕੇ ਆਪਾਂ ਦੋਵਾਂ ਸਾਰਿਆਂ ਨੂੰ ਜੁਇੰਟ ਵੀ ਕਰ ਸਕਦੇ ਹੈਗੇ ਆ ਐਕਟਿੰਗ ਜਿਹੜਾ ਪਹਿਲਾਂ ਬਣਾਉਂਦੇ ਹੁੰਦੇ ਪਰਵਾਜ ਦੇ ਤਰੀਕਾ ਉਹ ਬਹੁਤ ਵਧੀਆ ਸੀਗਾ ਉਦੋਂ ਆਪਾਂ ਮਨਾਉਂਦੇ ਹੁੰਦੇ ਸੀਗੇ ਪੇਜ 'ਚ ਵੱਡੇ ਵੱਡੇ ਪੋਸਟ ਬਣਾਉਂਦੇ ਹੁੰਦੇ ਸੀਗੇ ਆਪਾਂ ਆਪਦੇ ਹੱਥ ਨਾਲ ਬਣਾਉਂਦੇ ਹੁੰਦੇ ਸੀਗੇ ਨਾਲ ਕਲਰ ਵਰਤਨੇ ਇੰਨੇ ਚੰਗੇ ਲੱਗਦੇ ਸੀਗੇ ਉਦੋਂ ਐਵੇਂ ਲੱਗਦੇ ਸੀ ਕਿ ਆਪਦਾ ਜਿਹੜਾ ਹੈਗਾ ਆਪਦੇ ਜਿਹੜਾ ਸਰੀਰ ਹੈਗਾ ਆਪਦਾ ਜਿਹੜਾ ਮਨ ਹੈਗਾ ਉਹ ਆਪਾਂ ਉਸ ਕਾਗਜ ਤੇ ਆਪਾਂ ਰੱਖਦੇ ਪਏ ਤੇ ਅੱਜ ਕੱਲ ਤਾਂ ਜਦਾ ਕੰਪਿਊਟਰ ਤੇ ਬਣਾਉਦੇ ਆ ਜਦਾ ਕੰਪਿਊਟਰ ਤੇ ਬਣਾਉਦੇ ਆ ਮੈਨੂੰ ਲੱਗਦਾ ਹੀ ਨਹੀਂ ਕਿ ਆਪਾਂ ਡੈਫੀਨੇਸ਼ਨ ਸ਼ੋ ਕਰਦੇ ਪਏ ਐਵੇਂ ਕਰਦੇ ਪਏ ਆ ਨਾ ਕਈਆਂ ਨੂੰ ਲੱਗਦਾ ਹੋਊਗਾ ਲੇਕਿਨ ਕਈਆਂ ਨੂੰ ਨਹੀਂ ਲੱਗਦਾ ਕਈਆਂ ਨੂੰ ਲੱਗਦਾ ਕਿ ਉਹ ਤਰੀਕਾ ਵਧੀਆ ਸੀਗਾ ਅੱਜ ਦਾ ਤਰੀਕਾ ਵਧੀਆ ਹੈ